ਮੈਂ ਤੁਹਾਨੂੰ ਇਹ ਪੁੱਛਣ ਲਈ ਫੋਨ ਕੀਤਾ ਸੀਗਾ ਕਿ ਮੈਂ ਬਠਿੰਡਾ ਤੋਂ ਲਖਨਊ ਜਾਣ ਵਾਲੀ ਟ੍ਰੇਨ ਬਾਰੇ ਤੁਹਾਡੇ ਤੋਂ ਕੁਛ ਜਾਣਕਾਰੀ ਪੁੱਛਣੀ ਸੀ ਇਹਦੇ ਵਿੱਚ ਇਹ ਵੀ ਪੁੱਛਣਾ ਸੀਗਾ ਕਿ ਟ੍ਰੇਨ ਜੋ ਹੈ ਕਿੰਨੇ ਵਜੇ ਬਠਿੰਡਾ ਤੋਂ ਚੱਲੇਗੀ ਅਤੇ ਲਖਨਊ ਕਿੰਨੇ ਵਜੇ ਪਹੁੰਚੇਗੀ ਮਤਲਬ ਕਿ ਇਹਦੇ ਵਿੱਚ ਕਿੰਨੇ ਘੰਟੇ ਦਾ ਸਫਰ ਮੈਨੂੰ ਤੈਅ ਕਰਨਾ ਪਵੇਗਾ ਅਤੇ ਇਹਦੇ ਨਾਲ ਮੈਨੂੰ ਇਹ ਵੀ ਦੱਸ ਦਿਓ ਕਿ ਉਸ ਕੋਚ ਕਿਹੜੇ ਕਿਹੜੇ ਕੋਚ ਨੇ ਉਹਦੇ ਵਿੱਚ ਅਤੇ ਹਰੇਕ ਕੋਚ ਦੇ ਵਿੱਚ ਜੋ ਸੀਟ ਹੈ ਕਿਹੜੀ ਮੈਨੂੰ ਮਿਲ ਸਕਦੀ ਹੈ ਅਤੇ ਉਸ ਦੇ ਹਿਸਾਬ ਨਾਲ ਉਹਦੇ ਵਿੱਚ ਉਹਦਾ ਕਿਰਾਇਆ ਕੀ ਹੋਵੇਗਾ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਸਫਰ ਦੇ ਵਿੱਚ ਜੇ ਲੰਬਾ ਸਫਰ ਹੈ ਤਾਂ ਕੋਸ਼ਿਸ਼ ਕਰਿਓ ਕਿ ਜੋ ਸੀਟ ਹੋਵੇਗੀ ਉਹ ਥੋੜ੍ਹੀ ਵਧੀਆ ਹੋਵੇ ਤਾਂ ਕਿ ਮੈਨੂੰ ਵਾਰ ਵਾਰ ਸੀਟ ਚੇਂਜ ਕਰਨ ਦੀ ਲੋੜ ਨਾ ਪਵੇ